ਜਿਸ ਅਸ ਅੰਮਰਸ ਅੰਮ੍ਰਿਤਸਰ ਦੇ ਵਿੱਚ ਘੁੰਮਣ ਵਿੱਚ ਬਹੁਤ ਸਾਰੀਆਂ ਥਾਵਾਂ ਨੇ ਔਰ ਉੱਥੇ ਦੇਖਿਆ ਜਾਂਦਾ ਹੈ ਕਿ ਅਕਸਰ ਲੋਕ ਗੋਲਡਨ ਟੈਂਪਲ ਦੇਖਣ ਆਉਂਦੇ ਨੇ ਗੋਲਡਨ ਟੈਂਪਲ ਫਿਰ ਕੀ ਕਹਿੰਦੇ ਆ ਦੁਰਗਿਆਣਾ ਮੰਦਰ ਰਾਮ ਤੀਰਥ ਅਤੇ ਕੀ ਕਹਿੰਦੇ ਨੇ ਆਪਣਾ ਸ਼ਹੀਦਾਂ ਸਾਹਿਬ ਜੀ ਦਾ ਗੁਰਦੁਆਰਾ ਹੈਗਾ ਦੇਖਣ ਵਾਸਤੇ ਅਤੇ ਸੈਰ ਸਪਾਟਾ ਬਹੁਤ ਵਧੀਆ ਹੈਗਾ ਉੱਥੇ ਹੋਰ ਸੈਰ ਸਪਾਟਾ ਕਰਨ ਅ ਨੂੰ ਕਈ ਲੋਕ ਉੱਥੇ ਕੰਪਨੀ ਬਾਗ ਜਾਂਦੇ ਨੇ ਦੇਖਣ ਕੰਪਨੀ ਬਾਗ ਬੜਾ ਵਧੀਆ ਦੇਖਣ ਵਾਲਾ ਹੈਗਾ ਉੱਥੇ ਅਤੇ ਅਸੀਂ ਇੱਕ ਵਾਰੀ ਸੋਚਿਆ ਕਿ ਚਲੋ ਇੱਥੋਂ ਪਹਿਲੇ ਅਸੀਂ ਗੋਲਡਨ ਟੈਂਪਲ ਜਾਈਏ ਗੋਲਡਨ ਟੈਂਪਲ ਤੋਂ ਫਿਰ ਅਸੀਂ ਦੁਰਗਿਆਣਾ ਦੇਖਿਆ ਦੁਰਗਿਆਣਾ ਤੋਂ ਬਾਅਦ ਅਸੀਂ ਫਿਰ ਉੱਥੇ ਕੀ ਕਹਿੰਦੇ ਨੇ ਸ਼ਹੀਦਾਂ ਸਾਹਿਬ ਗੁਰਦੁਆਰਾ ਦਰਸ਼ਨ ਕੀਤੇ ਫਿਰ ਉਸ ਤੋਂ ਬਾਅਦ ਅਸੀਂ ਉੱਥੇ ਅਗਲੇ ਦਿਨ ਫਿਰ ਅਸੀਂ ਸੋਚਿਆ ਵੀ ਯਾਰ ਕਿੱਥੇ ਜਾਇਆ ਜਾਵੇ ਫਿਰ ਅਸੀਂ ਅਗਲੇ ਦਿਨ ਉੱਥੇ ਕੀ ਕਹਿੰਦੇ ਆ ਓ ਕੀ ਕਹਿੰਦਾ ਵਾਹਗਾ ਬੋਡਰ ਦੇਖਣ ਗਏ ਬੋਰਡਰ ਦੇ ਵਿੱਚ ਅਸੀਂ ਟੈਕਸੀ ਕੀਤੀ ਟੈਕਸੀ ਕਰਕੇ ਗਏ ਔਰ ਇੱਥੋਂ ਦਾ ਬਜਟ ਬਿਲਕੁਲ ਵੀ ਠੀਕ ਸੀ ਅਸੀਂ ਦੇਖਿਆ ਕਿ ਵੀਹ ਤੋਂ ਪੱਚੀ ਹਜ਼ਾਰ ਰੁਪਇਆ ਸਾਡਾ ਖਰਚਾ ਜਿਹੜਾ ਸੀ ਉਹ ਹੋ ਗਿਆ ਸੀ ਔਰ ਇੱਥੇ ਹੋਰ ਵੀ ਬੜੀ ਆਂ ਜਗ੍ਹਾ ਦੇਖਣ ਵਾਲੀਆਂ ਹਨ ਲੇਕਿਨ ਇੱਥੇ ਖ਼ਾਸ ਕਰ ਯੇ ਹੈਗੇ ਇੱਥੇ ਇੱਕ ਇੱਥੋਂ ਦਾ ਇੱਕ ਢਾਬਾ ਬੜਾ ਮਸ਼ਹੂਰ ਹੋਇਆ ਕੇਸਰ ਦਾ ਢਾਬਾ ਉੱਥੋਂ ਦਾ ਖਾਣਾ ਬਹੁਤ ਵਧੀਆ ਹੈਗਾ ਔਰ ਦੇਸੀ ਘਿਓ ਦੀ ਪਿਓਰ ਥਾਲੀ ਦਿੰਦੇ ਹਨ ਔਰ ਥਾਲੀ ਵੀ ਬੜੇ ਬਜਟ ਦੇ ਵਿੱਚ ਆ ਜਾਂਦੀ ਹੈ ਤੇ